ਜੇ ਘੋੜੇ ਅਤੇ ਘੋੜ ਸਵਾਰੀ ਨੂੰ ਜੇ ਆਪਾਂ ਦੋਵਾਂ ਨੂੰ ਅਲੱਗ ਅਲੱਗ ਪੱਧਰ 'ਤੇ ਦੇਖੀਏ ਜਾਂ ਇੱਕ ਸਾਥ ਵੀ ਦੇਖੀ ਤਾਂ ਜਿਹੜੀ ਰਕਾਬ ਜਿਹੜਾ ਹੈਗਾ ਇੰਸਟਰੂਮੈਂਟ ਹੈ ਜਿਹੜਾ ਰਾ ਰਾਈਡਿੰਗ 'ਚ ਵਰਤਿਆ ਜਾਂਦਾ ਅਤੇ ਹੁਣ ਆਦੇ ਸੈਂਟਰਲ ਏਸ਼ੀਆ ਨੂੰ ਆਪਾਂ ਕੇਂਦਰੀ ਜਿਹੜਾ ਏਸ਼ੀਆ ਦਾ ਹਿੱਸਾ ਆ ਜਿਹੜੇ ਕਰਗਸਤਾਨ ਨਾਮ ਦਾ ਦੇਸ਼ ਹੈ ਉੱਥੇ ਡਿਵੈਲਪ ਹੋਇਆ ਸੀ ਪਰ ਉਹਦੇ ਮਗਰੋਂ ਜਦੋਂ ਬੰਦੇ ਨੇ ਪਹਿਲੀ ਵਾਰ ਇਸ ਜਾਨਵਰ ਨੂੰ ਕਾਬੂ ਕੀਤਾ ਅਤੇ ਇਸ ਤੋਂ ਆਪਣੀ ਵਰਤੋਂ ਦਿਨ ਪ੍ਰਤੀ ਦਿਨ ਅਤੇ ਸਫ਼ਰ ਕਰਨ ਦਾ ਅਤੇ ਜੰਗਾ ਵੀ ਲੜੀਆਂ ਉਹਦੇ ਮਗਰੋਂ ਇਸ ਦੇ ਨਾਲ ਨਾਲ ਇਸ 'ਤੇ ਬੈਠ ਕੇ ਕਈ ਖੇਲ ਵੀ ਸ਼ੁਰੂ ਹੋਏ ਜਿਹਨਾਂ ਖੇਲਾਂ ਵਿੱਚੋਂ ਸ਼ੁਰੂ ਸ਼ੁਰੂ ਵਿੱਚ ਪੋਲੋ ਜਿਹਨੂੰ ਚੁਗਾਣ ਵੀ ਕਹਿੰਦੇ ਆ ਚੁਗਾਣ ਸੈਂਟਰਲ ਏਸ਼ੀਆ 'ਚ ਇਹ ਡਿਵਲਪ ਹੋਇਆ ਟੈਂਟ ਪੈੱਗਿੰਗ ਅਤੇ ਟੈਂਟ ਪੈੱਗਿੰਗ ਨੇਜਾਬਾਜ਼ੀ ਵੀ ਜਿਵੇਂ ਪਾਕਿਸਤਾਨ 'ਚ ਇਹਦੇ ਵਾਸਤੇ ਅਲਫਾਜ਼ ਵਰਤੇ ਜਾਂਦੇ ਅਤੇ ਪੰਜਾਬ 'ਚ ਵੀ ਨੇਜਾਬਾਜੀ ਜਾਣਦੇ ਹੋਣ ਇਸ 'ਚ ਇਸ ਹਿੱਸੇ 'ਚ ਅਤੇ ਪੋਲੋ ਨੇਜਾਬਾਜੀ ਸ਼ੋ ਜੰਪਿੰਗ ਇਹੋ ਜਿਹੇ ਕਈ ਖੇਡ ਨੇ ਇਹ ਅਤੇ ਹੰਟਿੰਗ ਵੀ ਕੀਤੀ ਜਾਂਦੀ ਹੈ ਅਤੇ ਫ ਫਰੀ ਬੈਕ ਲੋਂਗ ਰਾਈਡਿੰਗ ਬਹੁਤ ਸਾਰੇ ਇਹੋ ਜਿਹੇ ਖੇਡ ਵੀ ਡਿਵੈਲਪ ਹੋਏ ਇਹ ਦੇ ਨਾਲ ਨਾਲ ਅਤੇ ਇਹਨਾਂ ਖੇਡਾਂ ਨੂੰ ਦੇਖੀਏ ਤਾਂ ਘੋੜੇ ਨਾਲ ਬੋਂਡਿੰਗ ਨੇਚਰ ਨੂੰ ਇੰਜੋਏ ਕਰਨਾ ਇਹ ਸਾਰੀ ਚੀਜ਼ਾਂ ਇਹਨਾਂ ਦੇ ਇੱਕ ਜੋੜ ਅਤੇ ਮੇਲ ਜੋੜ ਨਾਲ ਬਣਿਆ ਅਤੇ ਘੋੜਸਵਾਰੀ ਨੂੰ ਮੈਂ ਦੇਖਾਂ ਤਾਂ ਐਜ ਏ ਪਰਸਨ ਮੈਨੂੰ ਲੋਂਗ ਰਾਈਟਸ ਬੜੀ ਪਸੰਦ ਨੇ ਉਸ ਤੋਂ ਮਗਰੋ ਅਤੇ ਮੈਨੂੰ ਟੈਂਟ ਪੈੱਗਿੰਗ ਬੜਾ ਪਸੰਦ ਟੈਂਟ ਪੈੱਗਿੰਗ ਐਸ ਸਪੋਰਟ ਵੋਰ ਦੇ ਟਾਈਮ ਵਿੱਚ ਜੰਗ ਦੇ ਟਾਈਮ ਵਿੱਚ ਡਿਵੈਲਪ ਹੋਇਆ ਸੀ ਜਦੋਂ ਇੱਕ ਤਰਫ਼ ਦੂਜੀ ਸੈਨਾ ਨੂੰ ਜਦੋਂ ਰਾਤ ਨੇ ਉਹਨਾਂ ਨੂੰ ਉੱਥੇ ਡੇਰਾ ਲਾਇਆ ਸੀ ਕੈਂਪ ਲਾਇਆ ਸੀ ਉਸ ਡੇਰੇ ਨੂੰ ਪੁੱਟਣ ਵਾਸਤੇ ਜਦੋਂ ਦੂਜੀ ਸੈਨਾ ਨੇ ਘੋੜੇ 'ਤੇ ਬੈਠ ਕੇ ਪਾਲਾ ਲੈ ਕੇ ਹੱਥ 'ਚ ਹੱਥ 'ਚ ਨੇਜਾ ਫੜ੍ਹ ਕੇ ਜਿਹਨੂੰ ਨੇਜਾ ਕਹਿੰਦੇ ਆ ਨੇਜਾ ਫੜ੍ਹ ਕੇ ਉਹਨਾਂ ਦੇ ਟੈਂਟ ਪਾੜੇ ਸੀ ਅਤੇ ਰਾਤ ਨੂੰ ਉਹਨਾਂ ਨੂੰ ਹਮਲਾ ਕੀਤਾ ਸੀ ਤਾਂ ਉਦੋਂ ਉਹ ਜੰਗ 'ਚ ਵਰਤੀ ਗਈ ਤਕਨੀਕ ਸੀ ਬਾਅਦ 'ਚ ਜਿਵੇਂ ਜਿਵੇਂ ਦੌਰ ਵੱਧਦਾ ਗਿਆ ਉਹ ਡਿਵੈਲਪ ਹੁੰਦੀ ਗਈ ਐਜ ਏ ਖੇਡ ਐਜ ਏ ਸਪੋਰਟ ਅਤੇ ਹਾਲੇ ਵੀ ਪਾਕਿਸਤਾਨ 'ਚ ਅਤੇ ਲਾਗੇ ਦੁਆਲੇ ਉਹਨਾਂ ਵਿੱਚ ਜਿਹੜੇ ਦੇਸ਼ ਹੈ ਜਿਵੇ ਅਫਗਾਨਿਸਤਾਨ ਹੈ ਅਤੇ ਉਹਨਾਂ ਦੇ ਕਲਚਰ ਵਿਚ ਨੇਜਾ ਬਾਜੀ ਅਤੇ ਇਹ ਸਭ ਖੇਡ ਜਿਹੜੇ ਪੋਲੋ ਹੈ ਚੁਗਾਨ ਹੈ ਇਹ ਸਾਰੇ ਖੇਡ ਡਿਵੈਪਲ ਹੋਏ ਅਤੇ ਨੇਜਾਬਾਜੀ ਮੈਂ ਕਹਿ ਸਕਦਾ ਵੀ ਮੇਰਾ ਇੱਕ ਪੰਸਦੀਦਾ ਸਪੋਰਟ ਹੈ ਮੇਰਾ